ਸਾਡੇ ਇਲਾਕੇ ਵਿੱਚ ਆਮ ਤੌਰ 'ਤੇ ਬੱਸਾਂ ਦੀ ਆਵਾਜਾਈ ਹੈ ਪਰ ਬੱਸਾਂ ਦੀ ਗਿਣਤੀ ਘੱਟ ਹੋਣ ਕਾਰਨ ਬੱਸਾਂ ਵਿੱਚ ਭੀੜ ਬਹੁਤ ਰਹਿੰਦੀ ਹੈ ਇਸ ਕਾਰਨ ਸਾਡੇ ਬੱਸਾਂ ਦਾ ਕਿਰਾਇਆ ਵੀ ਬਹੁਤ ਹੈ ਜੋ ਕਿ ਅਗਰ ਬੱਸਾਂ ਹੋਰ ਵਧ ਜਾਣ ਜਾਂ ਬੱਸਾਂ ਦੀ ਗਿਣਤੀ ਵਧ ਜਾਵੇ ਤਾਂ ਕਿਰਾਇਆ ਅਤੇ ਬੱਸਾਂ ਵਿੱਚ ਭੀੜ ਦੀ ਕਮੀ ਹੋ ਸਕਦੀ ਹੈ ਅਤੇ ਆਉਣ ਜਾਣ ਵਾਲੇ ਯਾਤਰੀਆਂ ਨੂੰ ਵਧੇਰੇ ਸਹੂਲਤ ਮਿਲ ਸਕਦੀ ਹੈ ਆਉਣ ਜਾਣ ਲਈ ਯਾਤਰੀਆਂ ਨੂੰ ਵਧੇਰੇ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਣਾ ਬੱਸਾਂ ਦੀ ਗਿਣਤੀ ਵਧਣ ਕਰਕੇ ਕਿਰਾਏ ਦਾ ਵੀ ਵਿਸ਼ੇਸ਼ ਫਰਕ ਪਵੇਗਾ ਸਰਕਾਰੀ ਬੱਸਾਂ ਨੂੰ ਸਟਾਰਟ ਕਰਨ ਲਈ ਅਤੇ ਉਹਨਾਂ ਦਾ ਕਿਰਾਇਆ ਜਾਇਜ਼ ਰੱਖਣ ਕਰਕੇ ਆਮ ਜਨਤਾ ਜੋ ਡੇਲੀ ਟਰਾਂਸਪੋਰਟ ਕਰਦੀਆਂ ਹਨ ਇੱਧਰੋਂ ਉੱਧਰ ਜਾਂਦੇ ਹਨ ਉਹਨਾਂ ਨੂੰ ਬਹੁਤ ਫਾਇਦਾ ਹੋਏਗਾ